ਜਿਵੇਂ ਕਿ ਆਪਾਂ ਦੇਖ ਹੀ ਸਕਦੇ ਆਂ ਅੱਜ ਕੱਲ ਦੀ ਜਿਹੜੀ ਟੈਕਨੋਲੋਜੀ ਹੈਗੀ ਹੈਗੀ ਉਹ ਕੀ ਆ ਬਹੁਤ ਹੀ ਜ਼ਿਆਦਾ ਵੱਧ ਚੁੱਕੀ ਹੈਗੀ ਹੈਗੀ ਠੀਕ ਆ ਅੱਜ ਕੱਲ ਦੇ ਬੱਚੇ ਬੁੱਢੇ ਜਵਾਨ ਇਹ ਸਾਰੇ ਕਿ ਸੋਸ਼ਲ ਮੀਡੀਆ ਦਾ ਬਹੁਤ ਹੀ ਜਿਆਦਾ ਯੂਜ ਕਰਨ ਲੱਗ ਪੈਂਦੇ ਹੈਗੇ ਠੀਕ ਹ ਜਿਵੇਂ ਉਹ ਅੱਜ ਕੱਲ ਜਿਹੜੇ ਬੁੱਢੇ ਬੱਚੇ ਜਵਾਨ ਹ ਸਾਰੇ ਇਸਟਾਗਰਾਮ ਵਟਸਐਪ ਯੂਟਿਊਬ ਸਨੈਪਚੈਟ ਇਨਾ ਸਾਰਿਆਂ ਦਾ ਕੀ ਹੈਗਾ ਬਹੁਤ ਹੀ ਜਿਆਦਾ ਯੂਜ ਕਰਦੇ ਹੈਗੇ ਹੈਗੇ ਕਈ ਇਹਨਾਂ ਨੂੰ ਆਪਦੇ ਇੰਟਰਟੇਨਮੈਂਟ ਪਰਪਸ ਦੇ ਲਈ ਵੀ ਯੂਜ ਕਰਦੇ ਹੈਗੇ ਕਈ ਇਹਨਾਂ ਨੂੰ ਆਪਦੇ ਐਜੂਕੇਸ਼ਨ ਲੈਵਲ ਨੂੰ ਇਨਕਰੀਜ ਕਰਨ ਦੇ ਲਈ ਵੀ ਯੂਜ ਕਰਦੇ ਹੈਗੇ ਆ ਸੋਸ਼ਲ ਮੀਡੀਆ ਦੇ ਬਹੁਤ ਹੀ ਜ਼ਿਆਦਾ ਐਡਵਾਂਟੇਜ ਐਂਡ ਡਿਸਐਡਵਾਂਟੇਜ ਵੀ ਹੁੰਦੇ ਹੈਗੇ ਉਵੇਂ ਕੀ ਹੈਗਾ ਗਾ ਆਪਾਂ ਆਪਦੇ ਮੋਸ਼ਨ ਨੂੰ ਪ੍ਰਗਟ ਕਰਦੇ ਹੈਗੇ ਥਰੂ ਡਾਂਸ ਤੇ ਸੋਸ਼ਲ ਮੀਡੀਆ ਦੇ ਆਪਾਂ ਸੋਸ਼ਲ ਮੀਡੀਆ ਦੇ ਵਿੱਚ ਕੀ ਹੈਗਾ ਡਾਂਸ ਹੁੰਦਾ ਉਹ ਆਪਾਂ ਕਈ ਮੌਕਿਆ ਤੇ ਪਾ ਸਕਦੇ ਹੁੰਦੇ ਆ ਆਪਾਂ ਯੂਟਿਊਬ ਇੰਸਟਾਗ੍ਰਾਮ ਇਹਨਾਂ ਤੋਂ ਆਪਾਂ ਕੋਈ ਵੀ ਡਾਂਸ ਵਗੈਰਾ ਦੀ ਪ੍ਰੈਕਟਿਸ ਲੈ ਸਕਦੇ ਹੈਗੇ ਕਈ ਵਾਰੀ ਕੀ ਆ ਆਪਾਂ ਸੋਸ਼ਲ ਮੀਡੀਆ ਤੋਂ ਕੋਈ ਡਾਂਸ ਸਿੱਖਦੇ ਕਈ ਵਾਰੀ ਕੋਈ ਡਾਂਸ ਅਗਰ ਆਪਾਂ ਕੋਈ ਵੀ ਵਧੀਆ ਸਿੱਖਿਆ ਹੁੰਦਾ ਹੈਗਾ ਤਾਂ ਆਪਾਂ ਕੀ ਹ ਕਈ ਵਾਰੀ ਨੈਸ਼ਨਲ ਤੋਂ ਇੰਟਰਨੈਸ਼ਨਲ ਲੈਵਲ ਤੱਕ ਵੀ ਪਹੁੰਚ ਸਕਦੇ ਹੈਗੇ ਕੱਥਕ ਕਲੀ ਡਾਂਸ ਗਿੱਧਾ ਭੰਗੜਾ ਇਹ ਸਾਰੇ ਕਿ ਆਪਾਂ ਯੂਟਿਊਬ ਇੰਸਟਾਗ੍ਰਾਮ ਵਗੈਰਾ ਤੋਂ ਕਿ ਸਿੱਖ ਸਕਦੇ ਹੈਗੇ ਕਈ ਇੰਟਰੋਵਰਟ ਬੰਦੇ ਹੁੰਦੇ ਹੈਗੇ ਵੀ ਜਿਹੜੇ ਕਿ ਕਿਸੇ ਦੇ ਅੱਗੇ ਡਾਂਸ ਨਹੀਂ ਕਰ ਸਕਦੇ ਹੁੰਦੇ ਤਾਂ ਉਹ ਕੀ ਹੈ ਯੂਟਿਊਬ ਯਾਂ ਇੰਸਟਾਗ੍ਰਾਮ ਤੋਂ ਡਾਂਸ ਕੱਢ ਕੇ ਉਹਨਾਂ ਤੋਂ ਸਿੱਖ ਸਕਦੇ ਆ ਬਿਨਾਂ ਕਿਸੇ ਝਿਜਕ ਦੇ ਅੱਜਕੱਲ ਆਨਲਾਈਨ ਕਲਾਸਿਜ ਵੀ ਬਹੁਤ ਹੁੰਦੀ ਹੈਗੀਆ ਵੀ ਅਗਰ ਕੋਈ ਵੀ ਜਿਹਨੂੰ ਕੋਈ ਵੀ ਡਾਂਸ ਨਹੀਂ ਆਉਂਦਾ ਹੁੰਦਾ ਕੋਈ ਡਾਂਸ ਦਾ ਸਟੈਪ ਨਹੀਂ ਆਉਂਦਾ ਉਹ ਯੂਟੀਊਬ ਦੇ ਉੱਤੋਂ ਡਾਂਸ ਦੇ ਸਟੈਪ ਕੱਢ ਕੇ ਉਹ ਡਾਂਸ ਨੂੰ ਸਿੱਖ ਸਕਦਾ ਹੈਗਾ ਗਾ